ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਪੰਜਾਬੀ ਭਾਸ਼ਾ ਨੇ ਸਾਨੂੰ ਸੱਭਿਆਚਾਰ ਰਹਿਣ ਸਹਿਣ ਪਹਿਰਾਵਾ ਰੀਤੀ ਰਿਵਾਜ਼ ਅਤੇ ਹੋਰ ਸਾਰੀਆਂ ਪਰਿਵਾਰਕ ਢਾਂਚਾ ਇਹ ਪੰਜਾਬੀ ਭਾਸ਼ਾ ਨੇ ਸਾਨੂੰ ਦਿੱਤਾ ਹੈ ਪੰਜਾਬੀ ਭਾਸ਼ਾ ਦੀ ਸਾਡੇ ਰਾਜ ਦੀ ਅਮੀਰ ਸੱਭਿਆਚਾਰ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਹੈ ਕਿਉਂਕਿ ਜੋ ਪੰਜਾਬੀ ਪਹਿਰਾਵਾ ਹੈ ਉਹਦਾ ਇੱਕ ਵੱਖਰਾ ਹੀ ਅਨੰਦ ਹੈ ਜਦੋਂ ਤੁਸੀਂ ਕਿਤੇ ਪੰਜਾਬੀ ਪਹਿਰਾਵਾ ਪਾ ਕੇ ਜਾਂਦੇ ਹੋ ਆਪਣਾ ਪੰਜਾਬੀ ਸੱਭਿਆਚਾਰ ਕਿਸੇ ਨੂੰ ਦਿਖਾਉਂਦੇ ਹੋ ਤਾਂ ਬਹੁਤ ਜ਼ਿਆਦਾ ਲੋਕ ਖੁਸ਼ ਹੁੰਦੇ ਹਨ ਪੰਜਾ ਕਿਉਂਕਿ ਜਿਹੜੇ ਬਾਹਰਲੇ ਬਾਹਰਲੇ ਸਟੇਟਾਂ ਦੇ ਲੋਕ ਹੈ ਉਹ ਪੰਜਾਬ ਦੀ ਜੋ ਵਿਰਾਸਤ ਹੈ ਜੋ ਪੰਜਾਬ ਦਾ ਸੱਭਿਆਚਾਰ ਹੈ ਉਹਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਸਾਡੇ ਰੀਤੀ ਰਿਵਾਜ਼ ਜਾਗੋ ਸਾਡਾ ਭੰਗੜਾ ਸਾਡਾ ਗਿੱਧਾ ਇਹਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਉਹ ਸ ਲੋਕ ਦੇਖਣ ਆਉਂਦੇ ਨੇ ਪੰਜਾਬ ਸਪੈਸ਼ਲ ਜਦੋਂ ਕਿਤੇ ਵਿਆਹ ਹੁੰਦਾ ਜਾਗੋ ਨਿਕਲਦੀ ਹੈ ਤਾਂ ਬਾਹਰੋਂ ਵ ਜਿਹੜੀ ਹੋਰ ਨ ਵਿਦੇਸ਼ਾਂ ਦੇ ਨੇ ਜਾਂ ਹੋਰ ਸਟੇਟਾਂ ਦੇ ਨੇ ਉਹ ਕਿੰਨਾਂ ਖੁਸ਼ ਹੁੰਦੇ ਨੇ ਦੇਖ ਕੇ ਇਸ ਤਰ੍ਹਾਂ ਜਿੱਦਾਂ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਏ ਖਾਲਸਾ ਬਣਿਆ ਹੋਇਆ ਹੈ ਉਹਦੇ ਵਿੱਚ ਸਾਡਾ ਪੂਰਾ ਸੱਭਿਆਚਾਰ ਦਰਸਾਇਆ ਗਿਆ ਹੈ ਕਿੱਦਾਂ ਪੰਜਾਬੀ ਭਾਸ਼ਾ ਨੇ ਸੱਭਿਆਚਾਰ ਵਿਰਾਸਤ ਨੂੰ ਸੰਭਾਲਿਆ ਉਤਸ਼ਾਹਿਤ ਕੀਤਾ ਇਹ ਪੰਜਾਬੀ ਮਾਂ ਬੋਲੀ ਜਿਹੜੀ ਇੱਦਾਂ ਦੀ ਹੈ ਨਾ ਉਹ ਜਿਹੜਾ ਸੱਭਿਆਚਾਰ ਹੈ ਉਹਨੂੰ ਇੱਕ ਤਰ੍ਹਾਂ ਨਾਲ ਜੋੜ ਕੇ ਰੱਖਦੀ ਉਹਨੂੰ ਸੰਭਾਲ ਕੇ ਰੱਖਦੀ ਪੰਜਾਬ ਦੇ ਨੌਜਵਾਨਾਂ 'ਚ ਅਤੇ ਦੂਜੇ ਲੋਕਾਂ 'ਚ ਵੀ ਦੂਜੀਆਂ ਸਟੇਟ ਦੇ ਲੋਕਾਂ 'ਚ ਵੀ ਬਹੁਤ ਜ਼ਿਆਦਾ ਉਤਸ਼ਾਹਿਤ ਪੈਦਾ ਕਰਦੀ ਉਹ ਵੀ ਲੋਕ ਸਾਡੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਸਾਡਾ ਸੱਭਿਆਚਾਰ ਆਪਣੇ ਆਪ 'ਚ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ ਜਿੱਦਾਂ ਬਾਹਰਲੇ ਦੇਸ਼ ਹੋ ਗਏ ਕੈਨੇਡਾ ਹੋ ਗਿਆ ਉੱਥੇ ਜਿਹੜੇ ਇੰਗਰੇ ਜਿਹੜੇ ਅੰਗਰੇਜ਼ ਵੀ ਨੇ ਉਹ ਵੀ ਜਦੋਂ ਪੰਜਾ ਉਹ ਵੀ ਜਦੋਂ ਪੰਜਾਬੀ ਲੋਕਾਂ ਨੂੰ ਦੇਖਦੇ ਨੇ ਉਹਨਾਂ ਦਾ ਸੱਭਿਆਚਾਰ ਦੇਖਦੇ ਨੇ ਤਾਂ ਉਹ ਵੀ ਉੱਦਾਂ ਦੀ ਨਕਲ ਕਰਦੇ ਨੇ ਉੱਦਾਂ ਦੇ ਸੂਟ ਪਾਉਂਦੇ ਨੇ ਉੱਦਾਂ ਦਾ ਹੀ ਭੰਗੜਾ ਕਰਦੇ ਨੇ ਉਹ ਇੱਕ ਤਰ੍ਹਾਂ ਨਾਲ਼ ਸਾਡੇ ਸੱਭਿਆਚਾਰ ਨੂੰ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਇੱਦਾਂ ਫਿਰ ਪੰਜਾਬੀ ਭਾਸ਼ਾ ਨੇ ਇੱਕ ਸੱਭਿਆਚਰਕ ਅਮੀਰ ਵਿਰਸਾ ਸੰਭਾਲਿਆ ਹੋਇਆ ਅਤੇ ਇਸ ਤਰ੍ਹਾਂ ਉਤਸ਼ਾਹਿਤ ਕਰਦੀ ਹੈ ਕਿ ਉਹ ਦੂਜੀਆਂ ਜਿਹੜੀਆਂ ਵਿਦੇਸ਼ ਹੈ ਦੂਜੇ ਜਿਹੜੇ ਸਟੇਟ ਹੈ ਉਹ ਵੀ ਉਹਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ